ਹਾਂਜੀ ਕਿਵੇਂ ਹੋ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਮੈਮ ਆਹੀ ਨੇ ਆਪਣੀ ਡਿਸਟਰਿਕਟ ਦੇ ਵਿੱਚ ਸਕੂਲ ਤੁਹਾਨੂੰ ਪਤਾ ਹੀ ਹੈ ਆਤਮ ਮਤਲਬ ਸਕੂਲ ਹੈ ਜਿਸ ਤਰਾਂ ਆਰਮੀ ਸਕੂਲ ਹੋ ਗਿਆ ਹੈਰੀਟੇਜ ਹੈ ਉਥੇ ਹੀ ਲਾਓ ਮੈਡਮ ਜਿੱਥੇ ਤੁਹਾਨੂੰ ਪਤਾ ਆਪਣੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਸਿਖਾਈ ਜਾਏ ਆਪਣੇ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਮੈਮ ਇਹ ਤਾਂ ਸਹੀ ਆਪਣੇ ਬੱਚਿਆਂ ਨੂੰ ਪੰਜਾਬੀ ਤਾਂ ਆਉਣੀ ਚਾਹੀਦੀ ਹੈ ਆਪਦੀ ਮਾਤ ਭਾਸ਼ਾ ਬਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਜੋ ਕਿ ਤੁਹਾਨੂੰ ਪਤਾ ਸਕੂਲਾਂ ਦੀ ਹਾਂਜੀ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਹਿੰਦੀ ਇੰਗਲਿਸ਼ ਨੂੰ ਜ਼ਿਆਦਾ ਪ੍ਰਮੋਟ ਕਰਦੇ ਪਏ ਨੇ ਨਾ ਤਾਂ ਹਾਂ ਜ਼ਰੂਰੀ ਹੈ ਵੀ ਮਾਤ ਭਾਸ਼ਾ ਆਪਣੀ ਪਿੱਛੇ ਨਾ ਰਹੇ ਆਪਾਂ ਆਪਦੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਉਣੀ ਚਾਹੀਦੀ ਹੈ ਇੱਕ ਸਬਜੈਕਟ ਤਾਂ ਹੋਣਾ ਹੀ ਚਾਹੀਦਾ ਪੰਜਾਬੀ ਦਾ ਕੰਪਲਸਰੀ ਬੱਚਿਆਂ ਵਾਸਤੇ ਹਾਂਜੀ ਹਾਂਜੀ ਹਾਂਜੀ ਕਿਉਂਕਿ ਤੁਹਾਨੂੰ ਪਤਾ ਮੈਮ ਅੱਜ ਕੱਲ੍ਹ ਸਕੂਲਾਂ ਵਿੱਚ ਇਹ ਕਿਹਾ ਜਾਂਦਾ ਇੰਗਲਿਸ਼ ਬੋਲੋ ਹਿੰਦੀ ਵਿੱਚ ਗੱਲ ਕਰੋ ਹੈ ਨਾ ਕਿ ਸਕੂਲਾਂ ਵਿੱਚ ਤੁਹਾਨੂੰ ਪਤਾ ਜੁਰਮਾਨਾ ਲੱਗਦਾ ਬੱਚੇ ਪੰਜਾਬੀ ਬੋਲਦੇ ਨੇ ਤਾਂ ਤਾਂ ਆਪਾਂ ਪੇਰੈਂਟਸ ਨੂੰ ਇਹ ਕਰਨਾ ਚਾਹੀਦਾ ਬੱਚਿਆਂ ਨੂੰ ਆਪਾਂ ਪੰਜਾਬੀ ਵਾਸਤੇ ਹੈ ਨਾ ਸਿਖਾਈਏ ਪ੍ਰਮੋਟ ਕਰੀਏ ਆਪਦੀ ਮਾਤ ਭਾਸ਼ਾ ਨੂੰ ਨਾ ਕਿਉਂਕਿ ਆਪਣੇ ਬੱਚੇ ਜਿਹੜੇ ਹੈਗੇ ਪੰਜਾਬੀ ਭੁੱਲਦੇ ਜਾਂਦੇ ਨੇ ਅੱਜ ਦੇ ਟਾਈਮ ਵਿੱਚ

ਹਾਂਜੀ ਹਾਂਜੀ ਹਾਂਜੀ ਹਾਂਜੀ ਕਿਉਂਕਿ ਇੱਥੇ ਮੈਡਮ ਫਸਟ ਕਲਾਸ ਤੋਂ ਇਹ ਲਾਈ ਜਾਂਦੀ ਹੈ ਹਾਂਜੀ ਠੀਕ ਹੈ ਕਿਉਂਕਿ ਮੈਮ ਇੰਨਾ ਸਕੂਲਾਂ ਵਿੱਚ ਤਾਂ ਪੰਜਾਬੀ ਹੈਗੀ ਹੈ ਜਿਸ ਤਰ੍ਹਾਂ ਆਰਮੀ ਸਕੂਲ ਹੋ ਗਿਆ ਆਰਮੀ ਸਕੂਲ ਵਿੱਚ ਫਿਫਥ ਕਲਾਸ ਤੋਂ ਲੱਗਦੀ ਹੈ ਪੰਜਾਬੀ ਤਾਂ ਬਾਕੀ ਇਹ ਜਿਹੜੇ ਤੁਸੀਂ ਸਕੂਲ ਡਿਸਾਈਡ ਕਰੀ ਬੈਠੇ ਹੋ ਇਥੇ ਤਾਂ ਪੰਜਾਬੀ ਨੂੰ ਤੁਹਾਨੂੰ ਪਤਾ ਫਸਟ ਕਲਾਸ ਤੋਂ ਸਟਾਰਟ ਹੋਈ ਜਾਂਦੀ ਹੈ ਕਿਉਂਕਿ ਫਸਟ ਕਲਾਸ ਤਾਂ ਇੱਕ ਸਬਜੈਕਟ ਹੀ ਬਣ ਜਾਂਦਾ ਫਿਰ ਉਸਤੋਂ ਪਹਿਲੇ ਚਲੋ ਘਰ 'ਚ ਵਗੈਰਾ ਚ ਬੱਚੇ ਨੂੰ ਨਾ ਵਰਨਮਾਲਾ ਕਰਾਈ ਜਾਂਦੀ ਹੈ ਹਾਂਜੀ ਹਾਂਜੀ

ਹਾਂਜੀ ਚਲੋ ਹਾਂਜੀ ਨਹੀਂ ਮੈਮ ਇਹ ਚੀਜ਼ਾਂ ਤਾਂ ਤੁਸੀਂ ਦੇਖ ਕੇ ਲਾਇਓ ਆਪਦੇ ਬੇਟੇ ਨੂੰ ਠੀਕ ਹੈ ਜੀ ਠੀਕ ਹੈ ਜੀ ਥੈਂਕ